ਸਾਡੇ ਖੇਤਰ ਵਿੱਚ ਜਿਵੇਂ ਕਿ ਤਰਨ ਤਾਰਨ ਵਿੱਚ ਇੱਕ ਬਹੁਤ ਵੱਡਾ ਗਰਾਊਂਡ ਸਟੇਡੀਅਮ ਹੈ ਉੱਥੇ ਅਕਸਰ ਹੀ ਖੇਡ ਸਮਾਗਮ ਹੁੰਦੇ ਰਹਿੰਦੇ ਨੇ ਇਸ ਤੋਂ ਇਲਾਵਾ ਕਈ ਪ੍ਰੋਗਰਾਮ ਹੁੰਦੇ ਨੇ ਜਿਵੇਂ ਛੱਬੀ ਜਨਵਰੀ ਪੰਦਰਾਂ ਅਗਸਤ ਅਤੇ ਕਾਫੀ ਲੋਕ ਉੱਥੇ ਇਕੱਠੇ ਹੁੰਦੇ ਨੇ ਅਤੇ ਮਤਲਬ ਕਿ ਉਹਦੀ ਗਰਾਊਂਡ ਇੰਨੀ ਵੱਡੀ ਹੈ ਕਿ ਜੇਕਰ ਕੋਈ ਖੇਡ ਸਮਾਗਮ ਵੀ ਕਰਵਾਉਣਾ ਪਵੇ ਮਤਲਬ ਕਿ ਬੱਚੇ ਉੱਥੇ ਖੇਡਣ ਜਾਂਦੇ ਨੇ ਮੋਸਟਲੀ ਸਕੂਲਾਂ ਦੇ ਬੱਚੇ ਉੱਥੇ ਖੇਡਣ ਜਾਂਦੇ ਨੇ ਉੱਥੇ ਕ੍ਰਿਕਟ ਵਗੈਰਾ ਖੇਡਦੇ ਨੇ ਗਰਾਊਂਡ ਬਹੁਤ ਵੱਡੀ ਹੈ ਗ੍ਰੀਨਰੀ ਹੈ ਉੱਥੇ ਛਾਂ ਵੀ ਹੈ ਇੰਨੀ ਧੁੱਪ ਨਹੀਂ ਹੈ ਸਹੂਲਤਾਂ ਇਹ ਹੈ ਕਿ ਉੱਥੇ ਗਾਰਡ ਵੀ ਨੇ ਅਤੇ ਗਾਰਡ ਜੋ ਕਿ ਪ੍ਰੋਪਰ ਧਿਆਨ ਰੱਖਦੇ ਨੇ ਕਿ ਕੋਈ ਵੀ ਅਣਜਾਣ ਵਿਅਕਤੀ ਅੰਦਰ ਨਾ ਆਵੇ ਪੂਰੀ ਤਲਾਸ਼ੀ ਨਾਲ ਹੀ ਅੰਦਰ ਲਿਜਾਇਆ ਜਾਂਦਾ ਹੈ ਮੰਨ ਲਓ ਤੁਸੀਂ ਕ੍ਰਿਕਟ ਖੇਡਣੀ ਹੈ ਵੋਲੀਬੋਲ ਖੇਡਣਾ ਹੈ ਕੁਝ ਵੀ ਖੇਡਣਾ ਹੈ ਤਾਂ ਉੱਥੇ ਹਰ ਪ੍ਰਕਾਰ ਦੀ ਗਰਾਊਂਡ ਬਣੀ ਹੋਈ ਹੈ ਬਕਾਇਦਾ ਉੱਥੇ ਨੈਟ ਵੀ ਲੱਗੇ ਹੋਏ ਨੇ ਉੱਥੇ ਹਰ ਪ੍ਰਕਾਰ ਦਾ ਸਮਾਨ ਮਿਲਦਾ ਹੈ ਉੱਥੇ ਪਾਣੀ ਦਾ ਪ੍ਰਬੰਧ ਵੀ ਬਹੁਤ ਵਧੀਆ ਹੈ ਪਾਣੀ ਪੀਣ ਲਈ ਸਾਫ ਸੁਥਰਾ ਮਿਲਦਾ ਹੈ ਉੱਥੇ ਸਾਫ ਪਾਣੀ ਦੀਆਂ ਮਸ਼ੀਨਾਂ ਲੱਗੀਆਂ ਹੋਈਆਂ ਨੇ ਜਦ ਵੀ ਉੱਥੇ ਖੇਡ ਸਮਾਗਮ ਹੁੰਦੇ ਹਨ ਤਾਂ ਸ਼ਹਿਰ ਦੀਆਂ ਬਹੁਤ ਵੱਡੀਆਂ ਵੱਡੀਆਂ ਹਸਤੀਆਂ ਆਉਂਦੀਆਂ ਨੇ ਉਹਨਾਂ ਦੇ ਬੈਠਣ ਦਾ ਉੱਥੇ ਪੂਰਾ ਪ੍ਰਬੰਧ ਹੈ ਅਕਸਰ ਜਦੋਂ ਸਲਾਨਾ ਖੇਡ ਸਮਾਗਮ ਹੁੰਦਾ ਹੈ ਤਾਂ ਲੋਕਾਂ ਦੇ ਬੈਠਣ ਲਈ ਕੁਰਸੀਆਂ ਟੈਂਟ ਵਗੈਰਾ ਲਗਾਏ ਜਾਂਦੇ ਨੇ ਚਾਹ ਪਾਣੀ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ ਸੋ ਸਾਡੇ ਖੇਤਰ ਵਿੱਚ ਜਿਹੜਾ ਸਟੇਡੀਅਮ ਹੈ ਉਥੇ ਬਹੁਤ ਸਾਰੀਆਂ ਸਹੂਲਤਾਂ ਉਪਲਬਧ ਨੇ ਧੰਨਵਾਦ